ਭਾਰਤ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਥਾਨ ਆ ਮੇਅ ਬੀ ਸ਼ਿਮਲਾ ਕੁੱਲੂ ਮਨਾਲੀ ਪੰਜਾਬ ਜਾਂ ਜੰਮੂ ਕਸ਼ਮੀਰ ਇਹ ਕਾਫੀ ਸਾਰੇ ਸਥਾਨ ਹੈ ਸਥਾਨ ਨੇ ਅਤੇ ਉੱਥੋਂ ਦੇ ਲੋਕ ਹੈ ਜਿਹੜੇ ਘੁੰਮਣ ਫਿਰਨ ਆਉੇਂਦੇ ਨੇ ਛੁੱਟੀ ਗਰਮੀ ਦੀ ਛੁੱਟੀਆਂ ਦੇ ਵਿੱਚ ਅਤੇ ਲੋਕ ਪੂਰਾ ਇਹ ਇੰਨਜੋਏ ਕਰਦੇ ਨੇ ਛੁੱਟੀਆਂ ਨੂੰ ਅਤੇ ਇੱਥੋਂ ਦਾ ਜਿਹੜਾ ਮੌਸਮ ਆ ਉਹ ਬੜਾ ਵਧੀਆ ਹੁੰਦਾ ਹੈ